ਮੈਂ ਥੋੜ੍ਹਾ ਬਹੁਤ ਹੀ ਕਲਾਸੀਕਲ ਸਿੱਖਿਆ ਹੈ ਨੋਰਮਲ ਫੋਕ ਸੰਗੀਤ ਜਿਹੜਾ ਕਿ ਅੱਜ ਕੱਲ੍ਹ ਸਧਾਰਨ ਜਨਮਾਨਸ ਨੂੰ ਸਮਝ ਆਉਂਦਾ ਹੈ ਉਹਦਾ ਅਭਿਆਸ ਕਰਦਾ ਹਾਂ ਅਤੇ ਮੈਂ ਸਵੇਰੇ ਚਾਰ ਵਜੇ ਉੱਠ ਕੇ ਚਾਰ ਤੋਂ ਲੈ ਕੇ ਛੇ ਵਜੇ ਤੱਕ ਮੈਂ ਸਾਹ ਦਾ ਕੇਵਲ ਗਾਇਕੀ ਦੇ ਵਿੱਚ ਸੱਤ ਸੁਰ ਹੁੰਦੇ ਪਹਿਲਾ ਸੁਰ ਸਾਹ ਹੁੰਦਾ ਹੈ ਮੈਂ ਸਾਹ ਦਾ ਅਭਿਆਸ ਜ਼ਿਆਦਾ ਕਰਦਾ ਹਾਂ ਅਤੇ ਉਸ ਤੋਂ ਬਾਅਦ ਦੋ ਘੰਟੇ ਸਾਹ ਦਾ ਅਭਿਆਸ ਕਰਕੇ ਆਪਣੀ ਦਿਨਚਰਿਆ ਕਰ ਲਈ ਚਾਹ ਪਾਣੀ ਪੀਆ ਨਹਾ ਧੋ ਲਏ ਅਤੇ ਉਸ ਤੋਂ ਬਾਅਦ ਫਿਰ ਮੈਂ ਆਪਣੇ ਉੱਚ ਸੁਰਾਂ ਦਾ ਅਭਿਆਸ ਕਰਦਾ ਹਾਂ ਜਿਹਦੇ ਵਿੱਚ ਕਿ ਕਲਿਆਣ ਰਾਗ ਹੋ ਗਿਆ ਜਾਂ ਹੋਰ ਕੋਈ ਰਾਗ ਆਪਣੇ ਹੋ ਗਏ ਉਹਨਾਂ ਦਾ ਅਭਿਆਸ ਕਰ ਲਿਆ ਅਤੇ ਜੇ ਜਿਹੜੇ ਮੈਂ ਗੀਤ ਲਿਖਦਾ ਹਾਂ ਫਿਰ ਉਹਨਾਂ ਗੀਤਾਂ ਦੀ ਧੁਨ ਬਣਾਉਂਦਾ ਹਾਂ ਅਤੇ ਮੈਂ ਕੋਈ ਜ਼ਬਰਦਸਤ ਨਹੀਂ ਜਿੰਨਾ ਚਿਰ ਮੇਰਾ ਮਨ ਉਹਦੇ ਵਿੱਚ ਰਮ ਰਿਹਾ ਹੁੰਦਾ ਹੈ ਮੈਂ ਹਾਰਮੋਨੀਅਮ ਸੁਰਾਂ ਨੂੰ ਤਾਲ ਨੂੰ ਆਪਣੇ ਮਨ 'ਚ ਬਿਠਾ ਕੇ ਅਭਿਆਸ ਕਰਦਾ ਹਾਂ ਅਤੇ ਜਦੋਂ ਲੱਗਦਾ ਕਿ ਨਹੀਂ ਹੁਣ ਮੈਂ ਥੋੜ੍ਹਾ ਥੱਕ ਜਿਹਾ ਗਿਆ ਜਾਂ ਮੇਰਾ ਮਨ ਰਮ ਨਹੀਂ ਰਿਹਾ ਤਾਂ ਮੈਂ ਉਸ ਅਭਿਆਸ ਨੂੰ ਛੱਡ ਦਿੰਦਾ ਕਾਰਣ ਕਿ ਠੀਕ ਹੈ ਟਾਈਮ ਤਾਂ ਦੇਣਾ ਪੈਂਦਾ ਹੈ ਪਰ ਮੈਂ ਇਹ ਦੇਖਿਆ ਹੈ ਕਿ ਬੇਮਨ ਨਾਲ ਕੋਈ ਵੀ ਕੰਮ ਕਰਨਾ ਉਹਦਾ ਪਰਿਣਾਮ ਜਿਹੜਾ ਹੈ ਉਹ ਕੋਈ ਬਹੁਤਾ ਅੱਛਾ ਨਹੀਂ ਨਿਕਲਦਾ ਹੁੰਦਾ ਇਸ ਲਈ ਮੇਰੀ ਤਾਂ ਤਕਨੀਕ ਇਹ ਹੀ ਹੈ ਕਿ ਸੁਬਹ ਅਰਲੀ ਮੋਰਨਿੰਗ ਸਾਹ ਦਾ ਅਭਿਆਸ ਕਰਨਾ ਅਤੇ ਉਹ ਤੋਂ ਬਾਅਦ ਫਿਰ ਅਗਲੇ ਸੁਰਾਂ ਦਾ ਅਭਿਆਸ ਕਰਨਾ ਧੰਨਵਾਦ